ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਦੇ ਲਈ ਜਿਹੜਾ ਇਸ਼ਤਿਹਾਰ ਜਿਹੜਾ ਛ ਛਪਵਾਉਣਾ ਬਹੁਤ ਹੀ ਮਹੱਤਵਪੂਰਨ ਹੋ ਗਿਆ ਇਸ਼ਤਿਹਾਰ ਨਹੀਂ ਛਪਵਾਓਗੇ ਤਾਂ ਕੋਈ ਵੀ ਚੀਜ਼ ਬਾਰੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਚੱਲਦਾ ਮਤਲਬ ਇਸ਼ਤਿਹਾਰ ਜਿਹੜਾ ਉਹ ਬਹੁਤ ਹੀ ਇੰਪੋਰਟੈਂਟ ਹੈ ਜਿੱਦਾਂ ਕਿ ਕੋਈ ਵੀ ਚੀਜ਼ ਹੈ ਉਹਦਾ ਜਿਹੜਾ ਤੁਸੀਂ ਇਸ਼ਤਿਹਾਰ ਛਪਵਾ ਕੇ ਆਪਣੀ ਚੀਜ਼ ਬਾਰੇ ਦੱਸ ਸਕਦੇ ਹੋ ਕਿ ਇਹਦੇ ਵਿੱਚ ਕੀ ਹੈ ਕਿੱਦਾਂ ਕਰ ਸਕਦੇ ਹੈ ਕਿੱਥੇ ਹੈ ਆਪਣੀ ਲੋਕੇਸ਼ਨ ਵਗੈਰਾ ਜਿਹੜਾ ਉਹ ਸਭ ਦੇ ਸਕਦੇ ਹੋ ਅਤੇ ਉਹਨਾਂ ਵਿੱਚੋਂ ਜਿਹੜਾ ਇੱਕ ਹੈ ਉਹ ਫਿਜਿਕਸ ਵਾਲਾ ਦਾ ਜਿਹਦੇ ਨਾਲ ਮੈਂ ਬਹੁਤ ਹੀ ਪ੍ਰਭਾਵਿਤ ਹੋਈ ਸੀ ਫਿਜਿਕਸ ਵਾਲਾ ਦੀਆਂ ਜਿਹੜੀਆਂ ਉਹ ਕੋਚਿੰਗ ਸੈਂਟਰ ਹੈ ਉਹ ਔਨਲਾਈਨ ਵੀ ਅਵੇਲੇਬਲ ਹੈ ਔਰ ਔਫਲਾਇਨ ਵੀ ਅਗਰ ਤੁਸੀਂ ਜ਼ਿਆਦਾ ਅਮਾਊਂਟ ਪੇਅ ਨਹੀਂ ਕਰ ਸਕਦੇ ਮਤਲਬ ਰੈਂਟ ਵਗੈਰਾ ਰੂਮ ਰੈਂਟ ਵਗੈਰਾ ਨਹੀਂ ਪੇਅ ਕਰ ਸਕਦੇ ਤਾਂ ਤੁਸੀਂ ਔਨਲਾਈਨ ਵੀ ਮਤਲਬ ਬਹੁਤ ਹੀ ਘੱਟ ਅਮਾਊਂਟ ਵਿੱਚ ਜਿਹੜਾ ਉਹ ਉਹਨਾਂ ਦਾ ਜਿਹੜਾ ਬੈਚ ਹੈ ਉਹ ਲੈ ਸਕਦੇ ਹੋ ਅਤੇ ਉੱਥੋਂ ਪੜ੍ਹ ਆਪਣਾ ਕੋਈ ਵੀ ਕੋਮਪੀਟੀਟਿਵ ਐਗਜਾਮ ਹੈ ਜਿੱਦਾਂ ਕਿ ਐੱਨ ਡੀ ਏ ਸੀ ਡੀ ਐੱਸ ਐੱਸ ਐੱਸ ਸੀ ਵਗੈਰਾ ਜਿਹੜਾ ਉਹ ਕਲੀਅਰ ਕਰ ਸਕਦੇ ਹੋ ਉਹਦੇ ਵਿੱਚ ਜਿਹੜੇ ਆ ਟੀਚਰ ਬਹੁਤ ਹੀ ਵਧੀਆ ਕੁਆਲਿਟੀ 'ਚ ਪੜ੍ਹਾਉਂਦੇ ਹੈ ਮੈਂ ਉਹਨਾਂ ਦਾ ਏ ਏਅਰਫੋਰਸ ਵਾਲਾ ਬੈਚ ਲਿਆ ਸੀ ਜਿਹਦੇ ਵਿੱਚ ਟੀਚਰਸ ਨੇ ਬਹੁਤ ਹੀ ਅੱਛਾ ਪੜ੍ਹਾਇਆ ਉਹ ਸਾਨੂੰ ਡੀ ਪੀ ਵੀ ਵੀ ਡੇਲੀ ਸੈਂਡ ਕਰਦੇ ਹੈ ਡੇਲੀ ਪ੍ਰੈਕਟਿਸ ਪੇਪਰ ਵੀ ਸੈਂਡ ਕਰਦੇ ਹੈ ਔਰ ਉਹਨਾਂ ਨੂੰ ਸੋਲਵ ਵੀ ਕਰਵਾਉਂਦੇ ਹੈ ਧੰਨਵਾਦ